ਨਵੇਂ ਜਨਮੇ ਬੱਚਿਆਂ ਲਈ ਸਾਫ਼ ਸੁਥਰੇ ਅਤੇ ਸੁਰੱਖਿਅਤ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਅਸੀਂ ਬਹੁਤ ਸਾਰੇ ਉਪਾਅ ਕਰ ਸਕਦੇ ਹਨ ਜਿਵੇਂ ਕਿ ਸਾਫ਼ ਸੁਥਰਾ ਵਾਤਾਵਰ ਬਣਾ ਕੇ ਰੱਖੀਏ ਬੱਚੇ ਦੇ ਕੋਠੀ ਕਮਰੇ ਨੂੰ ਹਮੇਸ਼ਾ ਸਾਫ਼ ਸੁਥਰਾ ਅਤੇ ਧੂਲ ਮਿੱਟੀ ਤੋਂ ਮੁਕਤ ਰੱਖੀਏ ਬੱਚੇ ਦਾ ਸਮਾਨ ਨੂੰ ਹਮੇਸ਼ਾ ਸਹੀ ਤੌਰ 'ਤੇ ਧੋ ਕੇ ਰੱਖੀਏ ਜੇ ਕੋਈ ਵੀ ਬੱਚੇ ਨੂੰ ਛੂਹਣ ਜਾਂ ਗੋਦ ਵਿੱਚ ਚੁੱਕਣ ਵਾਲਾ ਹੋਵੇ ਉਹ ਆਪਣੇ ਹੱਥ ਧੋ ਲਵੇ ਆਪਾਂ ਹਵਾ ਅਤੇ ਪਾਣੀ ਦੀ ਦੀ ਸ਼ੁੱਧਤਾ ਵੀ ਰੱਖ ਸਕਦੇ ਹਨ ਜਿਵੇਂ ਕਿ ਘਰ ਦੀ ਹਵਾ ਤਾਜ਼ਾ ਰੱਖਣ ਲਈ ਰੋਜ਼ਾਨਾ ਵਾਤਾਵਰਨ ਨੂੰ ਹਵਾ ਦਿਓ ਘਰ ਦੀਆਂ ਖਿੜਕੀਆਂ ਖੋਲ੍ਹੋ ਪਾਣੀ ਵਾਲਾ ਪੀਣ ਉਬਾਲ ਕੇ ਜਾਂ ਫਿਰ ਫਿਲਟਰ ਰਾਹੀਂ ਸਾਫ਼ ਕੀਤੇ ਹੋਏ ਪਾਣੀ ਨੂੰ ਹੀ ਵਰਤੀਏ ਅਸੀਂ ਟੀਕਾਕਰਨ ਵੀ ਬੱਚਿਆਂ ਦਾ ਬਹੁਤ ਅੱਛੀ ਤਰੀਕੇ ਨਾਲ ਕਰਾ ਸਕਦੇ ਹਨ ਉਹਨਾਂ ਨੂੰ ਸਮੇਂ ਸਿਰ ਟੀਕਾ ਟੀਕੇ ਲਵਾਈ ਜਾਈਏ ਡਾਕਟਰੀ ਸਲਾਹ ਮੁਤਾਬਿਕ ਬੱਚੇ ਦੀ ਸਿਹਤ ਦੀ ਜਾਂਚ ਕਰਾਈਏ ਉਹਨਾਂ ਦੇ ਪੋਸ਼ਣ ਦਾ ਧਿਆਨ ਰੱਖੀਏ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵਧੀਆ ਹੁੰਦਾ ਹੈ ਜੋ ਉਹਨਾਂ ਦੀ ਰੋਕ ਪ੍ਰਤੀਰੋਧਕ ਤਾਕਤ ਵਧਾਉਂਦਾ ਹੈ ਜੇਕਰ ਬੱਚੇ ਨੂੰ ਦੁੱਧ ਛੱਡਣ ਵਾਲੀ ਉਮਰ ਵਿੱਚ ਪਹੁੰਚਾ ਦਿੱਤਾ ਗਿਆ ਹੈ ਤਾਂ ਤਾਜ਼ਾ ਅਤੇ ਪੋਸ਼ਟਿਕ ਭੋਜਨ ਦਿਓ ਸੰਪਰਕ ਅਤੇ ਭੀੜ ਤੋਂ ਬੱਚੇ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਕਿ ਬੱਚੇ ਨੂੰ ਬਹੁਤ ਵਧੇਰੇ ਲੋਕਾਂ ਵਾਲੀ ਥਾਂ 'ਤੇ ਲੈ ਲਿਜਾਣ ਤੋਂ ਪਹਿਲੇ ਗੁਰੇਜ਼ ਕਰੋ ਖ਼ਾਸ ਕਰਕੇ ਜਦੋਂ ਵਾਇਰਲ ਬਿਮਾਰੀਆਂ ਫੈਲ ਰਹੀਆਂ ਹੋਣ ਜੇਕਰ ਕਿਸੇ ਵੀ ਬੱਚੇ ਨੂੰ ਖੰਘ ਜ਼ੁਕਾਮ ਜਾਂ ਬੁਖਾਰ ਹੋਵੇ ਉਹ ਬੱਚੇ ਨਾਲ ਸੰਪਰਕ ਕਰਨ ਤੋਂ ਦੂਰ ਰਹੇ